ਪਿੰਡਾਂ ਵਿੱਚ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੀਆਂ ਬਹੁਤ ਜਿਹੀਆਂ ਖੇਡਾਂ ਖੇਡੀਆਂ ਜਾਂਦੀਆਂ ਹੈ ਜਿਨ੍ਹਾਂ ਵਿੱਚ ਜਿਹਨਾਂ ਦਾ ਆਪਣਾ ਬਹੁਤ ਮਹੱਤਵ ਹੈ ਹਰ ਇੱਕ ਖੇਡ ਦਾ ਆਪਣਾ ਤਰੀਕਾ ਹੈ ਖੇਡਣ ਵਾਲੇ ਬੰਦਿਆਂ ਦੀ ਸੰਖਿਆ ਹੈ ਅਤੇ ਖੇਡਣ ਦਾ ਤਰੀਕਾ ਅਤੇ ਜਗ੍ਹਾ ਅਤੇ ਉਹਨਾਂ ਦੀ ਜਿਹੜੀ ਚਾਹੀਦੀਆਂ ਚੀਜ਼ਾਂ ਹਨ ਵੱਖ ਵੱਖ ਹਨ ਆਮ ਤੌਰ 'ਤੇ ਜਿਹੜੇ ਪਿੰਡਾਂ ਦੇ ਖੇਡੀਆਂ ਜਾਂਦੀਆਂ ਖੇਡਾਂ ਹਨ ਜਿਵੇਂ ਕਿ ਗੁੱਲੀ ਡੰਡਾ ਹੋ ਗਿਆ ਪਿੱਠੂ ਸਿੱਕਾ ਹੋ ਗਿਆ ਚੋਰ ਪੁਲਿਸ ਹੋ ਗਿਆ ਬਰਫ ਪਾਣੀ ਹੋ ਗਿਆ ਇਹ ਸਭ ਖੇਡਾਂ ਆਮ ਤੌਰ 'ਤੇ ਬਣਾਈਆਂ ਹੋਈਆਂ ਪਿੰਡਾਂ ਦੀਆਂ ਹੀ ਹਨ ਅਤੇ ਇਹ ਮਨੋਰੰਜਨ ਦਾ ਇੱਕ ਸਾਧਨ ਹੈ ਇਹਨਾਂ ਵਿੱਚ ਕੋਈ ਇਹ ਨਹੀਂ ਹੈ ਕਿ ਇੱਕ ਪੱਕਾ ਰੂਲ ਹੁੰਦਾ ਹੈ ਇਸ ਵਿੱਚ ਆਮ ਤੌਰ 'ਤੇ ਜਿਹੜੇ ਬੱਚੇ ਖੇਡੇ ਕਰਦੇ ਹੁੰਦੇ ਹਨ ਉਹ ਆਪਣੇ ਹਿਸਾਬ ਨਾਲ ਰੂਲ ਅਤੇ ਚੀਜ਼ਾਂ ਤੈਅ ਕਰਦੇ ਹਨ ਜਿਵੇਂ ਕਿ ਅਸੀਂ ਇੱਕ ਚੀਜ਼ ਲੈ ਲਈਏ ਜਿਵੇਂ ਕਿ ਅਸੀਂ ਲੈ ਲਈਏ ਬਾਂਦਰ ਗੁੱਲਾ ਬਾਂਦਰ ਗੁੱਲਾ ਲੈ ਲਓ ਜਾਂ ਤੁਸੀਂ ਲੈ ਲਓ ਕਿ ਪਿੱਠੂ ਸੇਕਾ ਪਿੱਠੂ ਸੇਕੇ 'ਚ ਕੀ ਹੁੰਦਾ ਹੈ ਅਸੀਂ ਕੀ ਕਰਦੇ ਹਾਂ ਛੋਟੇ ਛੋਟੇ ਪੱਥਰ ਜਿਹੇ ਲੈ ਲੈਂਦੇ ਹਾਂ ਸੱਤ ਪੱਥਰ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ ਇੱਕ ਦੇ ਉੱਤੇ ਇੱਕ ਨੂੰ ਰੱਖਦੇ ਹਾਂ ਅਤੇ ਅਸੀਂ ਇੱਕ ਬੋਲ ਜੀ ਬਣਾ ਲੈਂਦੇ ਹਾਂ ਜਿਹੜੀ ਕਿ ਆਮ ਤੌਰ 'ਤੇ ਪਿੰਡਾਂ 'ਚ ਜਰਾਬਾਂ ਦੀ ਬਣਾਈ ਜਾਂਦੀ ਹੈ ਜਿਹਦੇ ਵਿੱਚ ਥੋੜ੍ਹਾ ਬਹੁਤਾ ਮਟੀਰੀਅਲ ਭਰਿਆ ਜਾਂਦਾ ਹੈ ਜਿਵੇਂ ਕਿ ਕਹਿ ਸਕਦੇ ਹਾਂ ਕਿ ਬੋ ਲਿਫਾਫ਼ੇ ਭਰ ਲੈਂਦੇ ਹਾਂ ਕਿ ਉਹ ਥੋੜ੍ਹਾ ਭਾਰਾ ਹੋ ਜੇ ਕਿ ਮਾਰਨ ਵਿੱਚ ਠੀਕ ਹੋਏ ਉਸ ਦੇ ਨਾਲ ਕੀ ਹੁੰਦਾ ਇੱਕ ਟੀਮ ਕੀ ਕਰਦੀ ਹੈ ਉਹਨਾਂ ਨੂੰ ਪ ਪੱਥਰਾਂ ਨੂੰ ਸ ਸੈਟ ਕਰਦੀ ਹੈ ਇੱਕ ਦੇ ਉੱਪਰ ਇੱਕ ਅਤੇ ਉਹ ਦੂਜਾ ਉਸ 'ਤੇ ਮਾਰਦਾ ਹੈ ਉਹ ਮਾਰਨ ਤੋਂ ਬਾਅਦ ਜਦੋਂ ਉਹ ਡਿੱਗ ਜਾਂਦੇ ਆ ਤਾਂ ਉਹ ਸਾਰੇ ਨੱਠਦੇ ਆ ਨੱਠਣ ਤੋਂ ਬਾਅਦ ਕੀ ਕਰਦੇ ਆ ਦੂਜੀ ਟੀਮ ਉਹਨਾਂ ਨੂੰ ਪਿੱਠੂ ਮਾਰ ਕੇ ਆਊਟ ਕਰਦੀ ਆ ਅਗਰ ਪਿੱਠੂ ਲੱਗ ਗਿਆ ਬੰਦਾ ਆਊਟ ਅਗਰ ਨਹੀਂ ਲੱਗਿਆ ਤਾਂ ਉਹ ਕੀ ਕਰਦੇ ਉਹਨਾਂ ਪੱਥਰਾਂ ਨੂੰ ਫਿਰ ਲਾਉਂਦੇ ਇੱਕ ਦਜੇ ਦੇ ਉੱਤੇ ਅਗਰ ਉਹ ਸਾਰੇ ਇੱਕ ਦੇ ਉੱਤੇ ਇੱਕ ਸੈਟ ਹੋ ਜਾਂਦੇ ਨੇ ਸਹੀ ਸਿਰ ਤਾਂ ਉਹ ਬਣ ਜਾਂਦਾ ਹੈ ਬਿਨਾਂ ਸਾਰੀ ਟੀਮ ਦੇ ਆਊਟ ਹੋਏ ਹੋਏ ਅਤੇ ਉਹ ਜਿੱਤ ਜਾਂਦੇ ਉਹਨਾਂ ਨੂੰ ਇੱਕ ਵਾਰੀ ਫੇਰ ਤੋਂ ਵਾਰੀ ਮਿਲਦੀ ਹੈ ਇਸੇ ਤਰ੍ਹਾਂ ਇੱਕ ਸਟੈਪੂ ਗੇਮ ਖੇਡੀ ਜਾਂਦੀ ਆ ਜਿਸ ਵਿੱਚ ਕੀ ਹੁੰਦਾ ਹੈ ਕਿ ਇੱਕ ਸਟੈਪੂ ਲਈ ਇੱਕ ਪੱਥਰ ਜਿਹਾ ਲਿਆ ਜਾਂਦਾ ਹੈ ਅਤੇ ਉਹਦੇ ਨਾਲ ਕੀ ਆ ਇੱਕ ਲੰਗੜੀ ਇਹ ਚੀਜ਼ਾਂ ਹੁੰਦੀਆਂ ਹਨ ਜਿਸ ਵਿੱਚ ਇੱਕ ਲੱਤ 'ਤੇ ਉ ਉਛਲ ਉਛਲ ਕੇ ਛਲਾਂਗਾ ਮਾਰ ਕੇ ਉਹਨਾਂ ਨੂੰ ਅੱਗੇ ਧਕੇਲਿਆ ਜਾਂਦਾ ਹੈ ਜਿਹਦੇ ਨਾਲ ਉਹ ਇੱਕ ਲਾਸਟ 'ਤੇ ਆ ਕੇ ਫਿਰ ਵਾਪਸ ਆਉਂਦੀਆਂ ਹਨ ਅਗਰ ਆ ਪੂਰਾ ਹੋ ਜਾਂਦਾ ਹੈ ਅਤੇ ਉਹ ਜਿੱਤ ਜਾਂਦੀਆਂ ਹਨ ਉਹਨਾਂ ਨੂੰ ਇੱਕ ਵਾਰ ਫਿਰ ਮੌਕਾ ਮਿਲਦਾ ਹੈ ਅਗਲੀ ਵਾਰੀ ਲਈ